ਹਰਿਆਲੀ ਤਾਂ ਸਭ ਨੂੰ ਬਹੁਤ ਵਧੀਆ ਲੱਗਦੀ ਹੈ ਇਹ ਸਾਨੂੰ ਓਕਸੀਜ ਵੀ ਪ੍ਰਦਾਨ ਕਰਦੀ ਹੈ ਅੱਜ ਕੱਲ੍ਹ ਲੋਕ ਪੇੜ ਬਹੁਤ ਕੱਟ ਰਹੇ ਹਨ ਜਿਸ ਕਰਕੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਗਰਮੀ ਵੱਧ ਰਹੀ ਹੈ ਜੋ ਆਪਾਂ ਨੂੰ ਵੀ ਮਤਲਬ ਓਕਸੀਜਨ ਦਿੰਦੇ ਹੈ ਆਪਾਂ ਉਨ੍ਹਾਂ ਨੂੰ ਹੀ ਕੱਟ ਦਿੰਦੇ ਹਾਂ ਦੇਖੋ ਅਤੇ ਮੈਨੂੰ ਬਾਗ਼ਬਾਨੀ ਕਰਨੀ ਬਹੁਤ ਪਸੰਦ ਹੈ ਮੈਂ ਆਪਣੇ ਘਰ ਵਿੱਚ ਆਪਣੇ ਘ ਆਪ ਖੁਦ ਹੀ ਸਬਜ਼ੀਆਂ ਬੀਜੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਕੋਈ ਕੈਮੀਕਲ ਨਹੀਂ ਹੈ ਅਸੀਂ ਆਪਣੇ ਘਰ ਦੀ ਖਾਦ ਬਣਾ ਕੇ ਉਹਨਾਂ ਵਿੱਚ ਪਾਨੇ ਹਾਂ ਘਰ ਦੀ ਬਣੀ ਖਾਦ ਨਾਲ ਤਿਆਰ ਕੀਤੀਆਂ ਸਬਜ਼ੀਆਂ ਹਨ ਜੋ ਕਿ ਬਜ਼ਾਰ ਵਿੱਚ ਲੈਣ ਜਾਓ ਉਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਕੋਈ ਟੀਕੇ ਨਾਲ ਤਿਆਰ ਕੀਤੀਆਂ ਹੁੰਦੀਆਂ ਹਨ ਆਪਾਂ ਦੇਖੋ ਆਪਾਂ ਕੋਈ ਸਬਜ਼ੀ ਜਾਂ ਕੇਲੇ ਵਗੈਰਾ ਕੋਈ ਫਰੂਟ ਹੀ ਲੈਂਦੇ ਹਾਂ ਦੇਖੋ ਉਨ੍ਹਾਂ ਨੂੰ ਵੀ ਅੱਜ ਕੱਲ ਟੀਕੇ ਨਾਲ ਪਕਾਇਆ ਹੋਇਆ ਦੇਖੋ ਠੀਕ ਹੈ ਜੀ ਹੁਣ ਆਪਾਂ ਸਟੋਰਾਂ 'ਚ ਵੀ ਰੱਖਕੇ ਆਪਾਂ ਨੂੰ ਵੀ ਖਾਣ 'ਚ ਦੇਖੋ ਵਧੀਆ ਨਹੀਂ ਹੁੰਦੀਆਂ ਵੀ ਆਪਾਂ ਹੁਣ ਆਪਾਂ ਦੇਖੋ ਆਪਾਂ ਘਰ ਦੀ ਬਣੀ ਖਾਦ ਨਾਲ ਤਿਆਰ ਕਰਦੇ ਹਾਂ ਸਬਜ਼ੀਆਂ ਵਗੈਰਾ ਉਹ ਆਪਾਂ ਨੂੰ ਕਿੰਨੀਆਂ ਵਧੀਆ ਲੱਗਦੀਆਂ ਹੈ ਆਪਾਂ ਨੂੰ ਤੰਦਰੁਸਤ ਰਹਿੰਦੇ ਹਾਂ ਕੋਈ ਆਪਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ